ਮੈਂ ਤੁਹਾਡੇ ਟੂਰ ਏਜੰਸੀ ਤੋਂ ਕੈਬ ਬੁੱਕ ਕਰਵਾਈ ਸੀ ਕਿਉਂਕਿ ਮੈਂ ਜਾਣਾ ਸੀ ਅਤੇ ਪਰ ਹੁਣ ਮੈਂ ਕਾਫੀ ਟਾਈਮ ਤੋਂ ਵੇਟ ਕਰ ਰਹੀ ਜਿਹੜਾ ਡਰਾਈਵਰ ਹੈ ਉਹ ਜਿਹੜਾ ਸਥਾਨ ਉਹਨੇ ਦੱਸਿਆ ਜਗ੍ਹਾ ਦੱਸੀ ਸੀ ਮੈਂ ਉੱਥੇ ਨਹੀਂ ਆ ਰਿਹਾ ਉਹ ਅਤੇ ਮੇਰਾ ਇੱਧਰ ਉੱਧਰ ਹੋ ਕੇ ਕਿਤੇ ਹੋਰ ਜਗ੍ਹਾ 'ਤੇ ਜਾਣਾ ਮੁਸ਼ਕਿਲ ਹੈ ਕਿਉਂਕਿ ਜਿ ਜੋ ਮੈਂ ਜਗ੍ਹਾ ਉਹਨੂੰ ਕਹੀ ਸੀ ਉੱਥੇ ਨਹੀਂ ਉਹ ਆ ਰਿਹਾ ਇਸ ਕਰਕੇ ਮੈਂ ਮੈਨੂੰ ਹੋਰ ਪਰੇਸ਼ਾਨੀ ਹੋ ਰਹੀ ਹੈ ਮੈਂ ਆਪਣੀ ਯਾਤਰਾ ਜਿਹੜੀ ਉਹਨੂੰ ਕੈਂਸਲ ਰੱਦ ਕਰਨੇ ਕਰਨਾ ਚਾਹੁੰਦੀ ਹਾਂ ਕਿਉਂਕਿ ਤੁਹਾਡਾ ਡਰਾਈਵਰ ਜਿਹੜਾ ਉਹ ਨਹੀਂ ਆ ਰਿਹਾ ਇੱਥੇ ਨਹੀਂ ਆ ਰਿਹਾ ਜਿੱਥੇ ਮੈਂ ਬੁਲਾਇਆ ਅਤੇ ਕਿਰਪਾ ਜਿਹੜੀ ਮੇਰੀ ਕਾਰ ਹੈ ਦੀ ਮੈਂ ਜਿਹੜੀ ਬੁਕਿੰਗ ਕੀਤੀ ਸੀ ਉਹਨੂੰ ਰੱਦ ਕੀਤਾ ਜਾਵੇ